ਕੰਮ 'ਤੇ ਅਕਸਰ ਗਲਤੀ ਹੋ ਜਾਂਦੀ ਹੈ ਅਸੀਂ ਕੰਮ ਕਰਦੇ ਹਾਂ ਤਾਂ ਕੁਝ ਨਾ ਕੁਝ ਗਲਤੀ ਹੋਣਾ ਸੁਭਾਵਿਕ ਹੀ ਹੈਗਾ ਅਤੇ ਇੱਕ ਵਾਰ ਮੈਂ ਕੁਝ ਪੰਜਾਬੀ ਦੇ ਅਕਸ਼ਰ ਟਾਈਪ ਕਰ ਰਿਹਾ ਸੀਗਾ ਤਾਂ ਉਸ ਤਰ੍ਹਾਂ ਕੋਈ ਬਿੰਦੀ ਟਾਈਪ ਹੋੜਾ ਨਹੀਂ ਲੱਗਿਆ ਅਤੇ ਮੈਂ ਫਿਰ ਉਸ ਨੂੰ ਪ੍ਰਿੰਟਰ 'ਚੋਂ ਦੇਖਿਆ ਤਾਂ ਗਲਤੀ ਸੀਗੀ ਅਤੇ ਮੈਂ ਉਹਨੂੰ ਸੁਧਾਰ ਕੇ ਅਤੇ ਨਵਾਂ ਪ੍ਰਿੰਟ ਕਰ ਲਿਆ